ਇਕ ਚੰਗੀ ਨਸਲ ਵਾਲੇ ਸਿਹਤਮੰਦ ਜਾਨਵਰਾਂ ਦੀ ਪਹਿਚਾਨ ਜਿਵੇਂ ਕਿ ਡੋਗੀ ਹੁੰਦਾ ਹੈ ਜਾਂ ਪੈੱਟ ਹੁੰਦਾ ਉਹਨਾਂ ਦੀਆਂ ਨਸਲਾਂ ਹੁੰਦੀਆਂ ਇੱਕ ਚੰਗੀ ਨਸਲ ਵਾਲਾ ਕੋਈ ਪੈੱਟ ਜਾਂ ਕੋਈ ਮੱਝ ਜਾਂ ਕੋਈ ਪਸ਼ੂ ਬਹੁਤ ਵਧੀਆ ਕੰਡੀਸ਼ਨ 'ਚ ਹੁੰਦਾ ਹੈ ਉਹਨਾਂ ਦੇ ਦੰਦਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਉਹਨਾਂ ਦੇ ਕੁਛ ਸਿਮਟਮ ਹੁੰਦੇ ਨੇ ਜਿਹੜੇ ਕਿ ਵਧੀਆ ਨਸਲਾਂ ਵਿੱਚ ਹੀ ਆਉਂਦੇ ਨੇ ਉਹ ਦੇਸੀ 'ਚ ਨਹੀਂ ਆਉਂਦੇ ਜਾਂ ਗਲੀ ਦੇ ਪੈੱਟ ਜਿਹੜੇ ਘੁੰਮਦੇ ਉਹਨਾਂ ਵਿੱਚ ਨਹੀਂ ਹੁੰਦੇ ਉਹ ਉਹਨਾਂ ਦੀ ਸਕਿਨ ਅਲੱਗ ਹੀ ਹੁੰਦੀ ਹੈ ਉਹਨਾਂ ਦੀਆਂ ਅੱਖਾਂ ਹੀ ਅਲੱਗ ਵਧੀਆ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਦੇ ਕੰਨ ਉਹਨਾਂ ਦੀ ਟੇਲ ਪੂੰਛ ਇਹ ਵਧੀਆ ਹੁੰਦੇ ਨੇ ਇੱਕ ਉਹਨਾਂ ਦੇ ਜਿਹੜੇ ਵਾਲ ਹੁੰਦੇ ਨੇ ਵਧੀਆ ਹੁੰਦੇ ਨੇ ਇਹਨਾਂ ਤੋਂ ਪਹਿਚਾਣ ਸਾਨੂੰ ਕੀਤੀ ਜਾ ਸਕਦੀ ਹੈ ਅਤੇ ਜਿਸਦੇ ਨਾਲ ਇਹ ਬਾਕੀ ਇਹਨਾਂ ਤੋਂ ਜ਼ਿਆਦਾ ਸਲਾਹ ਉਹ ਪਸ਼ੂਆਂ ਵਾਲੇ ਦੇ ਡਾਕਟਰਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਿਹੜੀ ਨਸਲ ਦੇ ਵਧੀਆ ਹੁੰਦੇ ਨੇ ਕਿਹੜੀ ਨਸਲ ਦੀ ਜਿਵੇਂ ਲੈਬਰਾ ਹੋ ਗਿਆ ਜਿਵੇਂ ਇਹ ਜਰਮ ਸ਼ੈਫੜ ਹੋ ਗਿਆ ਇਹ ਕੁੱਤੇ ਵਧੀਆ ਹੁੰਦੇ ਨੇ